ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਜੀ ਹਾਂਜੀ ਫਰਮਾਓ ਸਰ ਅੱਛਾ ਅੱਛਾ ਕਿਹੜਾ ਨਸ਼ਾ ਜੀ ਅੱਛਾ ਬਲੂਆਣੇ ਪਿੰਡ ਦੇ ਵਿੱਚ ਹਾਂ ਕੰਪਲੇਂਟਸ ਤਾਂ ਆਈਆਂ ਸੀ ਵਿੱਚ ਗਏ ਵੀ ਸੀ ਸਾਨੂੰ ਇਸ ਤਰ੍ਹਾਂ ਦਾ ਕੋਈ ਮਿਲਿਆ ਤਾਂ ਨਹੀਂ ਹੈ ਉਦੋਂ ਅਤੇ ਹੁਣ ਤੁਹਾਡੇ ਦੁਆਰਾ ਦੱਸਣ ਦੇ ਉੱਤੇ ਦੁਆਰਾ ਜਾਂਚ ਕਰਦੇ ਹਾਂ ਵੇਖਦੇ ਹਾਂ ਅਸੀਂ ਅਤੇ ਗੇੜਾ ਗੂੜਾ ਮਾਰ ਕੇ ਵੇਖਦੇ ਹਾਂ ਕਿਹੜੀ ਜਗ੍ਹਾ 'ਤੇ ਤੁਹਾਨੂੰ ਕੀ ਲੱਗਦਾ ਕਿਹੜੀ ਜਗ੍ਹਾ 'ਤੇ ਬੱਚੇ ਨਸ਼ਾ ਕਰਦੇ ਆ ਜਾਂ ਕੋਈ ਸਪਲਾਈ ਕਰ ਰਿਹਾ ਕੀ ਰਿਪੋਰਟ ਕੀ ਹੈ ਪਿੰਡ ਦੇ ਲੋਕ ਹੀ ਸਪਲਾਈ ਕਰ ਰਹੇ ਹੈ ਅਤੇ ਸਕੂਲਾਂ ਤੱਕ ਕੌਣ ਪਹੁੰਚਾਉਂਦਾ ਫਿਰ ਅੱਛਾ ਜਨਤਕ ਥਾਵਾਂ 'ਤੇ ਬੱਚੇ ਕਿੱ ਕਿੱਥੇ ਜਨਤਕ ਥਾਵਾਂ ਦੇ ਉੱਤੇ ਪੀਂਦੇ ਪੁੰਦੇ ਆ ਜਾਂ ਕਿੱਥੇ ਖੇਤ ਬੰਨੇ ਕਿੱਥੇ ਜਿੱਥੇ ਰੇਡ ਰੂਡ ਵੀ ਕਰ ਸਕੀਏ ਅਸੀਂ ਤੁਹਾਡੇ ਧਿਆਨ 'ਚ ਹੋਵੇ ਅੱਛਾ ਕੋਈ ਗੱਲ ਨਹੀਂ ਜੀ ਮੈਂ ਕਰਦਾ ਸੰਪਰਕ ਆਪਣੀ ਟੀਮ ਨਾਲ ਵੀ ਅਤੇ ਵੇਖਦੇ ਹਾਂ ਜਿਵੇਂ ਵੀ ਕੋਈ ਬਣਦਾ ਹੋਇਆ ਅਤੇ ਇਹ ਨੂੰ ਤਾਂ ਠੱਲ ਪਾਉਣੀ ਹਾਂ ਠੱਲ ਪਾਉਣੀ ਇਹਨੂੰ ਤਾਂ ਹਾਂ ਵੇਚਣ ਵਾਲਿਆਂ 'ਤੇ ਵੀ ਕਰਦੇ ਹਾਂ ਕਾਰਵਾਈ ਵੱਡੇ ਮਗਰਮੱਛ ਹੀ ਆ ਜਿਹੜੇ ਉਹ ਫੜਨੇ ਪੈਣੇ ਪਹਿਲਾਂ ਤਾਂ ਅਤੇ ਕੋਈ ਗੱਲ ਨਹੀਂ ਹਾਂ ਕੋਈ ਕੋਈ ਗੱਲ ਨਹੀਂ ਜੀ ਅਤੇ ਧਿਆਨ 'ਚ ਤੁਸੀਂ ਵੀ ਰੱਖਿਓ ਮਾੜਾ ਮੋਟਾ ਵੀ ਰਿਪੋਰਟ ਆ ਜਿਹੜੀ ਵੀ ਸਾਨੂੰ ਦਿੰਦੇ ਰਹਿਓ ਅਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਕਰਦੇ ਹਾਂ ਕਾਰਵਾਈ ਕੋਈ ਨਹੀਂ ਓ ਓਕੇ ਜੀ ਓਕੇ ਜੀ ਮਿਹਰਬਾਨੀ